ਬੁਣਾਈ ਨਾਲ ਸੰਬੰਧਿਤ ਮੇਰੀਆਂ ਬਹੁਤ ਸਾਰੀਆਂ ਇੱਛਾਵਾਂ ਹਨ ਮੈਂ ਆਪਣੇ ਘਰ ਵਾਲੇ ਦੇ ਨਾਲ ਉਹਦਾ ਹੱਥ ਵੰਡਾਉਂਦੀ ਹਾਂ ਮੈਂ ਇਹਨੂੰ ਬਾਜ਼ਾਰ ਦੇ ਵਿੱਚ ਬਣਾ ਬਣਾ ਕੇ ਸਮਾਨ ਬੁਣਾਈ ਦਾ ਕਰੋਸ਼ੀਏ ਦਾ ਵਸਤਰ ਬਣਾ ਕੇ ਬਜਾਰ ਵਿੱਚ ਵੀ ਵੇਚਦੀ ਹਾਂ ਮੈਂ ਯੂਟੀਊਬ ਤੋਂ ਅੱਜ ਕੱਲ੍ਹ ਬਹੁਤ ਕੁਛ ਸਿੱਖਦੀ ਹਾਂ ਮੈਨੂੰ ਬਹੁਤ ਇੱਛਾਵਾਂ ਹੈ ਕਿ ਮੈਂ ਬਹੁਤ ਕੁਛ ਸਿੱਖਾਂ ਅਤੇ ਬਣਾਵਾਂ ਮੈਂ ਆਡ ਗੁਆਂਡ ਦੇ ਘਰਾਂ ਵਿੱਚ ਜਾ ਜਾ ਕੇ ਵੀ ਇਹਨੂੰ ਵੇਚਦੀ ਹਾਂ ਅਤੇ ਲੋਕ ਬਹੁਤ ਇਹਨੂੰ ਪਸੰਦ ਕਰਦੇ ਹਨ ਅਤੇ ਮੇਰਾ ਨਾ ਬਹੁਤ ਸ਼ਾਬਾਸ਼ੀ ਮਿਲਦੀ ਹੈ ਕਿ ਤੂੰ ਬਹੁਤ ਵਧੀਆ ਬਣਾਉਂਦੀ ਹੈ ਬਹੁਤ ਸੋਹਣਾ ਦਿੰਦੀ ਹੈ ਬਣਾ ਕੇ ਅਤੇ ਮੈਨੂੰ ਲੋਕ ਹੋਰ ਵੀ ਉਹਨਾਂ ਦੇ ਰਿਸ਼ਤੇਦਾਰ ਸਾਰੇ ਜੋ ਵੀ ਹੈ ਹੋਰ ਕਹਿੰਦੇ ਨੇ ਕਿ ਤੁਸੀਂ ਬਣਾ ਬਣਾ ਕੇ ਸਾਨੂੰ ਭੇਜੋ ਅਤੇ ਦੁਕਾਨਦਾਰ ਵੀ ਮੈਨੂੰ ਬੜੇ ਆਰਡਰ ਦਿੰਦੇ ਹਨ ਮੈਂ ਉਹਨਾਂ ਦੇ ਆਰਡਰਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਇੱਛਾ ਰੱਖਦੀ ਹਾਂ ਔਰ ਇੱਕ ਬਹੁਤ ਉੱਚੇ ਮੁਕਾਮ 'ਤੇ ਪਹੁੰਚਣ ਦੀ ਇੱਛਾ ਰੱਖਦੀ ਹਾਂ ਆਪਣੀ ਬੁਣਾਈ ਦੇ ਨਾਲ ਆਪਣੇ ਸ਼ੌਂਕ ਦੇ ਨਾਲ ਅਤੇ ਮੈਨੂੰ ਬਹੁਤ ਅੱਛਾ ਲੱਗਦਾ ਕਿ ਮੈਂ ਇਹ ਸਭ ਕੁਛ ਬਣਾ ਕੇ ਆਪਣਾ ਵੇਚਦੀ ਹਾਂ ਆਪਣੇ ਬੱਚਿਆਂ ਦੀਆਂ ਫੀਸਾਂ ਕੱਢਦੀ ਹਾਂ ਵਿੱਚੋਂ ਅਤੇ ਉਹਨਾਂ ਦਾ ਪਾਲਣ ਪੋਸ਼ਣ ਵਧੀਆ ਕਰ ਸਕਦੀ ਹਾਂ ਮੈਂ ਇਹਦੇ ਨਾਲ ਅਤੇ ਮੇਰੀਆਂ ਇੱਛਾਵਾਂ ਇਹਦੇ ਨਾਲ ਹੋਰ ਵੀ ਵਧਦੀਆਂ ਨੇ ਕਿ ਮੈਂ ਹੋਰ ਵੀ ਅੱਛਾ ਅੱਛਾ ਸਭ ਕੁਛ ਕਰਾਂ ਅਤੇ ਯੂਟਿਊਬ ਤੋਂ ਸਿੱਖ ਕੇ ਮੈਂ ਨਵੀਆਂ ਨਵੀਆਂ ਚੀਜ਼ਾਂ ਸਿੱਖਦੀ ਹਾਂ ਅਤੇ ਬਣਾਉਂਦੀ ਹਾਂ ਅਤੇ ਉਹਨਾਂ ਨੂੰ ਵੇਚਦੀ ਵੀ ਹਾਂ